ਹੈਲੋ ਹਾਂਜੀ ਕੌਣ ਜੀ ਕੌਣ ਜੀ ਹਾਂਜੀ ਹਾਂਜੀ ਹਾਂਜੀ ਬੂਟ ਲੈ ਜਾਓ ਜੀ ਅੱਛਾ ਮੈਰਿਜ ਵਾਸਤੇ ਕਈ ਜੋੜੇ ਚਾਹੀਦੇ ਹੋਣਗੇ ਹੈਂ ਠੀਕ ਹੈ ਆਪਣੇ ਕੋਲ ਮਿਲ ਜਾਣਗੇ ਜੀ ਜੈਟਸ ਲੇਡੀਜ ਬੱਚਿਆਂ ਦੇ ਸਾਰੇ ਜਿਸ ਤਰ੍ਹਾਂ ਦੇ ਕਹੋਗੇ ਤੁਸੀਂ ਦੇ ਦੇਵਾਂਗੇ ਅਤੇ ਜੈਂਟਸ ਦੇ ਸ਼ੇਰਵਾਲੀ ਨਾਲ ਪਾਉਣ ਵਾਲੇ ਲੈਦਰ ਸ਼ੂਜ਼ ਵੀ ਮਿਲ ਜਾਣਗੇ ਜੀ ਜੁੱਤੀ ਮਿਲ ਜੂਗੀ ਅਤੇ ਸਪੋਰਟ ਸ਼ੂਜ ਲੈਣੇ ਜੀ ਜੀਨ ਵਗੈਰਾ ਨਾਲ ਪਾਉਣ ਦੇ ਲਈ ਆਪਣੇ ਕੋਲ ਐਡੀਡਾਸ ਨਾਈਕੀ ਰੀਵੋਕ ਸਕੈਚਰ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਉਹਨਾਂ ਦੀ ਕਾਪੀ ਵੀ ਮਿਲ ਜਾਂਦੀ ਹੈ ਫਸਟ ਕਾਪੀ ਉਹਨਾਂ ਦੇ ਰੇਟ ਘੱਟ ਹੁੰਦੇ ਅਰੀਜਨਲ ਵੀ ਮਿਲਜੂ ਨਹੀਂ ਨਹੀਂ ਓਰੀਜਨਲ ਵੀ ਦੇਵਾਂਗੇ ਬਿਲਕੁਲ ਬਿਲ ਕੱਟ ਕੇ ਦੇਵਾਂਗੇ ਤੁਹਾਨੂੰ ਰੀਜਨਲ ਦਾ ਹਾਂ ਰੀਜਨਲ ਵੀ ਮਿਲ ਜਾਣਗੇ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਤੁਸੀਂ ਜਦੋਂ ਮਰਜ਼ੀ ਆਓ ਜੀ ਲੇਡੀਜ ਵੀ ਜਿਸ ਤਰ੍ਹਾਂ ਦੀ ਜੁੱਤੀ ਹੈ ਜੀ ਜੁੱਤੀ ਮਿਲ ਜੂਗੀ ਸੈਂਡਲ ਮਿਲ ਜੂਗੇ ਸੈਂਡਲ ਮਿਲ ਜਾਣਗੇ ਜੀ ਬੈਲੀ ਮਿਲ ਜਾਊਗੀ ਅਤੇ ਹੋਰ ਜੋ ਵੀ ਚੀਜ਼ ਸ਼ੂਜ਼ ਚਾਹੀਦੇ ਆ ਸਪੋਰਟ ਸ਼ੂਜ ਚਾਹੀਦੇ ਆ ਹੋਰ ਇਸ ਤਰ੍ਹਾਂ ਦੇ ਮਿਲ ਜਾਣਗੇ ਜੀ ਲੇਡੀਜ਼ 'ਚ ਫੁੱਲ ਵਰੈਟੀ ਅ ਆਪਣੇ ਕੋਲ ਹਾਂ ਨਾ ਨਾ ਵਧੀਆ ਮਾਲ ਦੇਵਾਂਗੇ ਜੀ ਪੂਰਾ ਇੱਕ ਨੰਬਰ ਮਾਲ ਹੋਊਗਾ ਗਰੰਟੀ ਨਾਲ ਦੇਵਾਂਗੀ ਅਤੇ ਬਿਲ ਕੱਟ ਕੇ ਦੇਵਾਂਗੇ ਤੁਹਾਨੂੰ ਜਿਹੜੇ ਕੰਪਨੀ ਦਾ ਮਾਲ ਦੇਵਾਂਗੇ ਜੀ ਹਾਂਜੀ ਹਾਂਜੀ ਹੋਰ ਇਸ ਤੋਂ ਬਿਨਾਂ ਬੱਚਿਆਂ ਦੇ ਵੀ ਬਹੁਤ ਸੋਹਣੇ ਸੋਹਣੇ ਹਾਂ ਬੱਚਿਆਂ ਵਾਸਤੇ ਬਹੁਤ ਸੋਹਣੇ ਸੋਹਣੇ ਡਿਜ਼ਾਇਨ ਹੈਗੇ ਜੀ ਆਪਣੇ ਕੋਲ ਜਿਸ ਤਰ੍ਹਾਂ ਦਾ ਤੁਸੀਂ ਕਹੋਗੇ ਹਾਂ ਹਾਂ

ਹਾਂਜੀ ਹਾਂਜੀ ਹਾਂਜੀ ਨਹੀਂ ਮਿਲ ਜਾਣਗੇ ਜੀ ਬੱਚਿਆਂ ਵਾਲੇ ਫਲਾਵਰ ਵਾਲੇ ਵੀ ਮਿਲ ਜਾਣਗੇ ਜਿਸ ਤਰ੍ਹਾਂ ਦੀ ਤੁਹਾਨੂੰ ਰਿਕੁਆਇਰਮੈਂਟ ਤੁਸੀਂ ਆਓ ਜਦੋਂ ਮਰਜ਼ੀ ਤੁਹਾਡਾ ਦੁਕਾਨ ਆ ਜੀ ਅਤੇ ਤੁਹਾਨੂੰ ਸਾਰੀ ਵਰਾਇਟੀ ਦਿਖਾਵਾਂਗੇ ਜਿਸ ਤਰ੍ਹਾਂ ਤੁਸੀਂ ਪਸੰਦ ਕਰੋਂਗੇ ਜਿਸ ਤਰ੍ਹਾਂ ਦਾ ਕਹੋਗੇ ਉਸ ਤਰ੍ਹਾਂ ਦੇ ਮਿਲ ਜਾਣਗੇ ਅੱਛਾ ਜੀ ਨਹੀਂ ਨਹੀਂ ਜੀ ਤੁਹਾਡਾ ਪੂਰਾ ਸਾਰ ਹਰ ਇੱਕ ਤਰ੍ਹਾਂ ਦੇ ਤੁਹਾਡੇ ਰਿਕੁਆਇਰਮੈਂਟ ਪੂਰੀ ਕਰਾਂਗੇ ਜੀ ਜੋ ਵੀ ਚੀਜ਼ ਤੁਹਾਨੂੰ ਲੋੜ ਹੋਊਗੀ ਬੱਚਿਆਂ ਦਾ ਲੇਡੀਜ ਦਾ ਜੈਟਸ ਦਾ ਜਿਸ ਤਰ੍ਹਾਂ ਦਾ ਵੀ ਚਾਹੀਦਾ ਉਹ ਸਾਨੂੰ ਸਾਰਾ ਕੁਝ ਪੂਰਾ ਮਿਲੂ ਜੀ ਨਹੀਂ ਕਈ ਪ੍ਰਕਾਰ ਦੇ ਆਉਂਦੇ ਆ ਜੀ ਬਲੈਕ ਬਰਾਉਨ ਟੈਨ ਕਲਰ ਕਈ ਤਰ੍ਹਾਂ ਦੇ ਕਲਰ ਆਉਣ ਲੱਗ ਗਏ ਵੀ ਲੈਦਰ 'ਚ ਜੀ ਹੁਣ ਜਿਸ ਤਰਾਂ ਤੁਸੀਂ ਕਹੋਗੇ ਉਹ ਹੀ ਮਿਲ ਜਾਊਗਾ ਜੀ ਜੋ ਵੀ ਤੁਹਾਡੇ ਸ਼ੇਰਵਾਨੀ ਨਾਲ ਜਾ ਕੋਟ ਪੈਂਟ ਨਾਲ ਮੈਚ ਕਰਦਾ ਹੋਊਗਾ ਉਸ ਤਰ੍ਹਾਂ ਦਾ ਤੁਹਾਨੂੰ ਦਿਖਾ ਕੇ ਹਾਂਜੀ ਹਾਂ ਉਹ ਦੇ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਹਾਂ ਸ਼ੇਰਵਾਲੀ ਵਾਸਤੇ ਜੁੱਤੀ ਹਾਂਜੀ ਜੁੱਤੀ ਵਧੀਆ ਰਹੁ ਜੀ ਕਢਾਈ ਵਾਲੀ ਜੁੱਤੀ ਬਹੁਤ ਸੋਹਣੀ ਸੋਹਣੀ ਜੁੱਤੀਆਂ ਡਿਜ਼ਾਇਨ ਹੈਗੇ ਆਪਣੇ ਕੋਲ ਜੀ

ਨੋਰਮਲ ਵੀ ਮਿਲ ਜਾਣਗੇ ਹਾਂ ਜੀ ਲੈਦਰ ਸ਼ੂਜ਼ ਵੀ ਮਿਲ ਜਾਣਗੇ ਰੁਟੀਨ ਵੀਅਰ ਵੀ ਮਿਲ ਜਾਣਗੇ ਸਪੋਰਟਸ ਵੀ ਮਿਲ ਜਾਣਗੇ ਹਾਂਜੀ ਹਾਂ ਹਾਂਜੀ ਹਾਂ ਵਧੀਆ ਕੰਪਨੀ ਦੇ ਹੋਣਗੇ ਜੀ ਜਦੋਂ ਮਰਜ਼ੀ ਆਓ ਜੀ ਦੁਕਾ ਹਾਂ ਡਰੈਸ ਆਪਣਾ ਸਦਰ ਬਜਾਰ 'ਚ ਪਿੰਕੀ ਮਾਰਕੀਟ ਹੈ ਜੀ ਉੱਥੇ ਸ਼ੋਪ ਨੰਬਰ ਦਸ ਆ ਆਪਣੇ ਬਰਨਾਲਾ ਸਦਰ ਬਜਾਰ ਦੇ ਵਿਚ ਹਾਂਜੀ